ਹੈਲੋ ਹਾਂਜੀ ਮੈਂ ਤੁਹਾਡੀ ਕੰਪਨੀ ਤੋਂ ਔਡਰ ਕੀਤਾ ਸੀਗਾ ਡਿਨਰ ਸੈਟ ਦਾ ਕਰੋਕਰੀ ਦਾ ਹਾਂਜੀ ਹਾਂਜੀ ਉਹ ਮੈਨੂੰ ਇੱਕ ਤਾਂ ਮੈਨੂੰ ਟਾਈਮ ਸਿਰ ਨਹੀਂ ਪਹੁੰਚੀ ਦੂਸਰਾ ਮੈਨੂੰ ਕਿੰਨੀ ਹਰਾਸਮੈਂਟ ਹੋਈ ਮੈਂ ਕਿੰਨੇ ਫੋਨ ਕੀਤੇ ਉਹਨਾਂ ਨੂੰ ਕਿੰਨੀ ਵਾਰ ਮੈਨੂੰ ਫੋਨ ਕਰਨਾ ਪਿਆ

ਮੇਰੀ ਮਨਪਸੰਦ ਦੀ ਜੋ ਚੀਜ਼ ਮੈਂ ਉਹ ਟੀ ਵੀ ਸਕਰੀਨ 'ਤੇ ਵੇਖ ਕੇ ਔਡਰ ਕੀਤੀ ਸੀ ਉਹ ਕੁਛ ਵੀ ਨਹੀਂ ਸੀ ਉਹਦੇ ਵਿੱਚ ਬਿਲਕੁੱਲ ਅਲੱਗ ਸੀ ਦੂਸਰਾ ਇੰਨੀ ਲੇਟ ਡਿਲੀਵਰੀ ਆਈ ਪੇਮੈਂਟ ਮੈਨੂੰ ਪੂਰੀ ਕਰਨੀ ਪਈ ਉਹਦੇ ਵਿੱਚ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਤੁਹਾਨੂੰ ਸ਼ਿਪਿੰਗ ਚਾਰਜ ਨਹੀਂ ਪੈਣਗੇ ਬਟ ਮੈਨੂੰ ਉਹ ਵੀ ਪਏ ਕੋਈ ਵੀ ਮੈਨੂੰ ਇਹ ਸੈਟਿਸਫੈਕਟਰੀ ਕੰਮ ਨਹੀਂ ਲੱਗਿਆ ਤੁਹਾਡਾ ਤਸੱਲੀ ਬਖਸ਼ ਕੰਮ ਨਹੀਂ ਲੱਗਿਆ ਮੈਨੂੰ ਜਿਹਦੇ ਵਿੱਚ ਮੇਰੀ ਬਹੁਤ ਜ਼ਿਆਦਾ ਹਰਾਸਮੈਂਟ ਹੋਈ ਥੈਂਕ ਯੂ